ਹੈਲੋ ਬਲਦੇਵ ਭਾਅ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚਾਲ ਹੈ ਕ ਕਿੱਥੇ ਹੈ ਡਿਊਟੀ ਆਏ ਦੇ ਹੋ ਅੱਛਾ ਬਲਦੇਵ ਭਰਾ ਇੱਕ ਗੱਲ ਬੜੀ ਹੈ ਵੀ ਮੁੰਡੇ ਨੇ ਪੇਪਰ ਦਿੱਤਾ ਅਤੇ ਨੌਕਰੀ ਕਿਤੇ ਮਿਲੇ ਨਹੀਂ ਕਰਦੀ ਅਤੇ ਕਰੀਏ ਤਾਂ ਕੀ ਕਰੀਏ ਮੈਨੂੰ ਇਹ ਦੱਸੋ ਪਹਿਲਾਂ ਖਰਚਾ ਵੀ ਬੜਾ ਕਰ ਛੱਡਿਆ ਅਤੇ ਨਾ ਪੰਜਾਬ ਗੋਰਮੈਂਟ ਦੀ ਨੌਕਰੀ ਹੈ ਨਾ ਕੋਈ ਪ੍ਰਾਈਵੇਟ ਨੌਕਰੀ ਆ ਨਾ ਕੋਈ ਸੈਂਟਰ ਦੀ ਨੌਕਰੀ ਹੈ ਅਤੇ ਦੱਸੋ ਹੁਣ ਅਸੀਂ ਕਿੱਥੇ ਜਾਈਏ ਅਤੇ ਪਰੇਸ਼ਾਨ ਮੈਂ ਬਹੁਤ ਆ ਅਤੇ ਪੈਸੇ ਵੀ ਖਰਚ ਛੱਡਿਆ ਅੱਗੇ ਲੱਭੇ ਕੱਖ ਨਹੀਂ ਕਰਦਾ ਅਤੇ ਸਰਕਾਰਾਂ ਪੱਲੇ ਕੱਖ ਨਹੀਂ ਪਾਉਣ ਡੀਆਂ ਅਤੇ ਹੁਣ ਦਸੋ ਅਸੀਂ ਕੀ ਕਰੀਏ ਕੁਛ ਸਲਾਹ ਦਿਓ ਸਾਨੂੰ ਬਹੁਤ ਹਾਂ ਵਿਹਲਾ ਵਿਹਲਾ ਜੀ ਵਿਹਲਾ ਪੜ੍ਹ ਲਿਖ ਕੇ ਸਾਰੇ ਵਿਹਲਾ ਆ ਜੇ ਉਹਨੂੰ ਉਹਦੀ ਮਰਜ਼ੀ ਦਾ ਕੰਮ ਮਿਲਦਾ ਨਹੀਂ ਮਾੜਾ ਕੰਮ ਬੱਚਾ ਕਰਕੇ ਰਾਜ਼ੀ ਨਹੀਂ ਹੁਣ ਦੱਸੋ ਜਾਈਏ ਤਾਂ ਜਾਈਏ ਕਿੱਥੇ ਅੱਛਾ ਅਤੇ ਉਹ ਜਿਹੜੀ ਤੁਹਾਡੀ ਕੁੜੀ ਨੇ ਪੇਪਰ ਦਿੱਤਾ ਸੀ ਉਹਦਾ ਕੀ ਬਣਿਆ ਹਾਂ ਉਹ ਵੀ ਵਿਚਾਰੀ ਵਿਹਲੀ ਰਹਿ ਗਈ ਉਹਦਾ ਵੀ ਰਹਿੰਦਾ ਬਣਦਾ ਬਣਦਾ ਕੰਮ ਰਹਿ ਗਿਆ ਬਹੁਤ ਮੁਸ਼ਕਿਲ ਆ ਬਹੁਤ ਮੁਸ਼ਕਿਲ ਆ ਹੁਣ ਕੀ ਕਰਨਾ ਚੰਗਾ ਪ੍ਰਧਾਨ ਜੀ ਫਿਰ ਚਲੋ ਮੈਂ ਆਵਾਂਗਾ ਐਤਵਾਰ ਮਿਲਾਂਗਾ ਤੁਹਾਨੂੰ ਠੀਕ ਹੈ ਜੀ ਫਿਰ ਬਹਿ ਕੇ ਗੱਲਬਾਤ ਕਰਾਂਗੇ